ਦੋ ਜੂਨ ਦੋ ਹਜ਼ਾਰ ਤੇਈ ਉੱਨੀ ਅਕਤੂਬਰ ਉੱਨੀ ਸੌ ਸਤਾਨਵੇਂ ਵੀਹ ਅਕਤੂਬਰ ਦੋ ਹਜ਼ਾਰ ਇੱਕ ਇੱਕ ਜਨਵਰੀ ਉੱਨੀ ਸੌ ਛਿਆਨਵੇਂ ਅੱਠ ਮਾਰਚ ਉੱਨੀ ਸੌ ਪਚਾਨਵੇਂ